ਦੇਖੋ ਭਾਰਤ ਦੀ ਜਿਹੜੀ ਸਿਹਤ ਸੰਭਾਲ ਪ੍ਰਣਾਲੀ ਆ ਨਾ ਉਹ ਦੂਜੇ ਦੇਸ਼ਾਂ ਨਾਲੋਂ ਕੀ ਹੈ ਬਹੁਤ ਪਿਛੜੀ ਹੋਈ ਹੈਗੀ ਵੀ ਇਨ ਜਿਹੜਾ ਭਾਰਤ ਦਾ ਜਿਹੜਾ ਸਿਸਟਮ ਹੈਗਾ ਹੈ ਨਾ ਵੀ ਉਹ ਇੰਨਾਂ ਆਪਾਂ ਕਹਿ ਸਕਦੇ ਹਾਂ ਵੀ ਇੰਨਾਂ ਅੱਗੇ ਨਹੀਂ ਹੈਗਾ ਜਿੰਨਾਂ ਕਿ ਬਾਕੀ ਦੇਸ਼ ਨੇ ਭਾਰਤ ਜੇ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਛਿਆਟਵੇਂ ਨੰਬਰ 'ਤੇ ਹੈਗਾ ਉਹ ਇੱਕ ਸੌ ਪਚਾਨਵੇਂ ਦੇਸ਼ਾਂ 'ਚੋਂ ਅਤੇ ਜੇਕਰ ਅਸੀਂ ਹੈ ਨਾ ਆਲੇ ਦੁਆਲੇ ਦੇ ਹਸਪਤਾਲਾਂ ਜਾਂ ਕਲੀਨਿਕ 'ਚ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ ਹੈ ਨਾ ਸਭ ਤੋਂ ਪਹਿਲੀ ਗੱਲ ਕੀ ਹੈ ਜੇ ਹੁਣ ਆਪਾਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹਾਂ ਪਹਿਲਾਂ ਤਾਂ ਐਡੀਆਂ ਐਡੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਪਈਆਂ ਹੁੰਦੀਆਂ ਨਾ ਮਤਲਬ ਕਿ ਉੱਥੇ ਇੰਨਾਂ ਚਿਰ ਖੜ੍ਹਨਾ ਪੈਂਦਾ ਨਾ ਜਿਹੜੇ ਸਰਕਾਰੀ ਹਸਪਤਾਲ ਹੁੰਦੇ ਨੇ ਉੱਥੇ ਵਾਰੀ ਨਹੀਂ ਆਉਂਦੀ ਹੈਗੀ ਪਹਿਲਾਂ ਨਾ ਪਰਚੀ ਕਟਾਓ ਠੀਕ ਹੈ ਅਤੇ ਉੱਥੇ ਇੰਨੀ ਗਰਮੀ ਦੇ ਵਿੱਚ ਖੜ੍ਹਨਾ ਔਖਾ ਠੀਕ ਹੈ ਉੱਥੇ ਮਤਲਬ ਕਿ ਕਈ ਵਾਰੀ ਪਾਣੀ ਦੀ ਸੁਵਿਧਾ ਨਹੀਂ ਹੁੰਦੀ ਹੈ ਨਾ ਬਾਥਰੂਮ ਵਗੈਰਾ ਜਿਹੜੇ ਜਨਥਕ ਪਖਾਨੇ ਆ ਨਾ ਪਿਸ਼ਾਬ ਕਰਨੇ ਉਹ ਇੰਨੇ ਸਾਫ ਸੁਥਰੇ ਨਹੀਂ ਹੁੰਦੇ ਹੈਗੇ ਠੀਕ ਹੈ ਉੱਥੇ ਮਤਲਬ ਕਿ ਸਫਾਈ ਦਾ ਜਿਹੜਾ ਜਿਹੜਾ ਮੁੱਦਾ ਹੈਗਾ ਨਾ ਵੀ ਉਹ ਦ ਝੱਲਣਾ ਪੈਂਦਾ ਕਾਫੀ ਹੈ ਨਾ ਇੰਨਾਂ ਚਿਰ ਮਤਲਬ ਕਿ ਲੰਬੀ ਲਾਈਨ 'ਚ ਖੜ੍ਹਨ ਕਤਾਰ ਦੇ ਵਿੱਚ ਖੜ੍ਹਨ ਦੇ ਕਰਕੇ ਹੈ ਨਾ ਫਿਰ ਕਿਤੇ ਜਾ ਕੇ ਵਾਰੀ ਆਉਂਦੀ ਆ ਫਿਰ ਡਾਕਟਰ ਨੂੰ ਮਿਲਦੇ ਹਾਂ ਡਾਕਟਰ ਨਾਲ ਫਿਰ ਗੱਲਬਾਤ ਕਰਕੇ ਹੈ ਨਾ ਫਿਰ ਉਹ ਜਦੋਂ ਜਿਹੜੀ ਦਵਾਈ ਦੱਸਦਾ ਗਾ ਫਿਰ ਉਹ ਜਦੋਂ ਆਪਾਂ ਦਵਾਈ ਲੈਣ ਜਾਂਦੇ ਆਗੇ ਆ ਨਾ ਉੱਥੇ ਜਿਹੜੇ ਹੁੰਦੀ ਹੈਗੀ ਸਰ ਦਵਾਈ ਜਿਹੜੀ ਹੁਣ ਉਹ ਵੀ ਖਰਚੇ ਤੋਂ ਬਾਹਰ ਹੋ ਜਾਂਦੀ ਹੈ ਹੁਣ ਸਰਕਾਰੀ ਫੀਸ ਤੋਂ ਜਿੰਨੀ ਵੱਧ ਜਾਂਦੀ ਹੈ ਫੀਸ ਜਿਹੜੀ ਜਿਹੜੀ ਦਵਾਈ ਦੀ ਜਿਹੜੀ ਕੀਮਤ ਹੈਗੀ ਨਾ ਉਹ ਵੀ ਔਖਾ ਹੋ ਜਾਂਦਾ ਗਾ ਅਤੇ ਸਾਨੂੰ ਕੀ ਆ ਇ ਇਸ ਸੰਬੰਧੀ ਹੈ ਨਾ ਵੀ ਬਹੁਤ ਸਾਰੇ ਉਪਰਾਲੇ ਕਰਨੇ ਚਾਹੀਦੇ ਆ ਸਿਹਤ ਪੱਖੋਂ ਜਿਹੜਾ ਕਹਿ ਦਈਏ ਆਪਾਂ ਹੈ ਨਾ ਸਭ ਤੋਂ ਪਹਿਲਾਂ ਕੀ ਹੈਗਾ ਜਿਵੇਂ ਜਿਹੜੇ ਜਨਤਕ ਪਖਾਨੇ ਨੇ ਹੈ ਨਾ ਪਿਸ਼ਾਬ ਘਰ ਨੇ ਹੋ ਗਏ ਹੈ ਨਾ ਇਹ ਸਾਰੇ ਕੀ ਇਹਨਾਂ ਸਾਰੀਆਂ ਥਾਵਾਂ ਨੂੰ ਕੀ ਸਾਫ ਸੁਥਰਾ ਰੱਖਣਾ ਜਿਹੜੀ ਸਾਡੀ ਇੱਕ ਸਮਾਜਿਕ ਜਿੰਮੇਵਾਰੀ ਹੈਗੀ ਹੈ ਨਾ ਇਸੇ ਤਰੀਕੇ ਨਾਲ ਕੀ ਅਸੀਂ ਸਮਾਜ ਦੇ ਵਿੱਚ ਕਿ ਇੱਕ ਸੇਵਾ ਦੀ ਭਾਵਨਾ ਪੈਦਾ ਕਰ ਸਕਦੇ ਹੈ ਨਾ ਜਿਹਦੇ ਨਾਲ ਕੀ ਆ ਆਲਾ ਦੁਆਲਾ ਵੀ ਸਾਫ ਰਹੇਗਾ ਅਤੇ ਅਸੀਂ ਸਰੀਰਿਕ ਪੱਖੋਂ ਵੀ ਸਾਫ ਸੁਥਰੇ ਰਹਾਂਗੇ ਹੈ ਨਾ ਅਤੇ ਜਿਹੜੀ ਸਿਹਤ ਸਿੱਖਿਆ ਹੈਗੀ ਹੈ ਨਾ ਉਹਨੂੰ ਮਤਲਬ ਕਿ ਜ਼ਿਆਦਾ ਮ ਮਹੱਤਵ ਦੇਣਾ ਚਾਹੀਦਾ ਗਾ ਵੀ ਉਹਨੂੰ ਸਿਰਫ ਪੜ੍ਹਨ ਲੱਖਣ ਲਿਖਣ ਤੱਕ ਸੀਮਤ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਵੀ ਇਹਦੇ ਸੰਬੰਧੀ ਕਈ ਉਪਰਾਲੇ ਕਰਨੇ ਚਾਹੀਦੇ ਜਿਵੇਂ ਹੈ ਨਾ ਵੀ ਲੈਕਚਰ ਕਰਵਾ ਲਏ ਹੈ ਨਾ ਪ੍ਰੋਗਰਾਮ ਕਰਵਾਉਣੇ ਚਾਹੀਦੇ ਤਾਂ ਕਿ ਲੋਕ ਜਾਗਰੂਕ ਹੋਣ ਅਤੇ ਦੂਜੀ ਗੱਲ ਕੀ ਹੈਗੀ ਜਿਵੇਂ ਘਰ ਘਰ ਜਾ ਕੇ ਨਾ ਸਮਾਜ ਦੀ ਹਰੇਕ ਅੰਗ ਹੋ ਗਏ ਜਿਵੇਂ ਖਾਸ ਕਰ ਜਿਵੇਂ ਆਪਣੇ ਮਾਤਾ ਪਿਤਾ ਉਹ ਕਹਿਣਾ ਇਹਨਾਂ ਨੂੰ ਪਹਿਲਾਂ ਆਪਾਂ ਕ ਮਤਲਬ ਕਿ ਕਿਸੇ ਵੀ ਜ ਆਪਾਂ ਕਹਿ ਦਿੰਦੇ ਸੁਧਾਰ ਦਾ ਜਿਹੜਾ ਸ਼ੁਰੂਆਤ ਆ ਗਈ ਆਪਾਂ ਆਪ 'ਤੇ ਪਹਿਲਾਂ ਖੁਦ ਤੋਂ ਸ਼ੁਰੂ ਕਰਦੇ ਹਾਂ ਆਪਦੇ ਤੋਂ ਹੈ ਨਾ ਫਿਰ ਪਰਿਵਾਰ ਤੋਂ ਫਿਰ ਸਮਾਜ ਤੋਂ ਹੈ ਨਾ ਪਹਿਲਾਂ ਕੀ ਆਪਣੇ ਮਾਤਾ ਪਿਤਾ ਨੂੰ ਇਸ ਸੰਬੰਧੀ ਸਿੱਖਿਆ ਤੋਂ ਜਿਹੜੀ ਆਪਾਂ ਨੂੰ ਲਾਭ ਨੇ ਹੈ ਨਾ ਅਤੇ ਜਿਹੜੇ ਇਹਦੇ ਤੋਂ ਹੋਣ ਵਾਲੇ ਜਿਹੜੇ ਲਾਭ ਅਤੇ ਜਾਂ ਫਿਰ ਲਾ ਜਿਹੜੇ ਹਾਨੀਆਂ ਨੇ ਹੈ ਨਾ ਵੀ ਉਸ ਸੰਬੰਧੀ ਜਾਣਕਾਰੀ ਦੇਣੀ ਚਾਹੀਦੀ ਹੈਗੀ ਹੈ ਨਾ ਅਤੇ ਸਿਹਤ ਸੇਵਾਵਾਂ ਸੰਬੰਧੀ ਕੈਂਪ ਲੱਗਣੇ ਚਾਹੀਦੇ ਹੈਗੇ ਠੀਕ ਹੈ ਅਤੇ ਜਿਹੜੇ ਤਾਂ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਹੈ ਨਾ ਵੀ ਉਹ ਅਨਪੜ੍ਹ ਲੋਕਾਂ ਨੂੰ ਕੀ ਹੈ ਇੱਕ ਤਰ੍ਹਾਂ ਦਾ ਜਾਗਰੂਕ ਕਰ ਸਕਣ ਇਸ ਸੰਬੰਧੀ ਹੈ ਨਾ ਕੈਂਪ ਲਗਾ ਕੇ ਹੈ ਨਾ ਅਤੇ ਤਾਂ ਕੀ ਆ ਜੇ ਸਿਹਤਮੰਦ ਵਾਤਾਵਰਨ ਹੋਵੇਗਾ ਤਾਂ ਹੀ ਸਿਹਤਮੰਦ ਕੀ ਆ ਅਸੀਂ ਰਹਿ ਸਕਾਂਗੇ ਤਾਂ ਹੀ ਅਸੀਂ ਇਕ ਲੰਮਾ ਜਿਹੜਾ ਜੀਵਨ ਸ ਖੁਸ਼ਹਾਲੀ ਜਿਹੜਾ ਤੰਦਰੁਸਤ ਜਿਹੜਾ ਸੁਖੀ ਜਿਹੜਾ ਜੀਵਣ ਅਸੀਂ ਗੁਜ਼ਾਰ ਸਕਦੇ ਹਾਂ